ਹੈਲੋ ਸਰ ਸਤਿ ਸ਼੍ਰੀ ਕਾਲ ਸਰ ਕੈਬ ਤੋਂ ਬੋਲਦੇ ਪਏ ਜੇ ਸਰ ਸਰ ਅਸੀਂ ਇਸ ਤੋਂ ਇੱਕ ਡਰਾਈਵਰ ਨੂੰ ਬੁੱਕ ਕਰਵਾਇਆ ਸੀ ਪੀ ਬੀ ਬੀ ਅਠਤਾਲੀ ਪੰਦਰਾਂ ਗੱਡੀ ਲਈ ਸਰ ਤੁਸੀਂ ਤਾਂ ਕਹਿੰਦੇ ਸੀ ਵੀ ਅਸੀਂ ਡਰਾਈਵਰ ਨੂੰ ਟਾਈਮ ਸਿਰ ਭੇਜ ਦਾਂਗੇ ਪਰ ਸਰ ਤੁਸੀਂ ਡਰਾਈਵਰ ਨੂੰ ਟਾਈਮ ਨਾਲ ਨਹੀਂ ਭੇਜਿਆ ਅਸੀਂ ਬੜੀ ਟਾਈਮ ਤੋਂ ਉਡੀਕ ਕਰ ਰਹੇ ਹਾਂ ਅਸੀਂ ਪਿੰਡ ਢੰਡ ਖੜੇ ਹੋਏ ਹਾਂ ਸੜਕ ਦੇ ਉੱਪਰ ਬੱਚੇ ਵੀ ਨਾਲ ਸਾਡੇ ਖੜੇ ਹੋਏ ਆ ਇੰਨਾ ਟਾਈਮ ਖੜਿਆਂ ਚੰਗਾ ਨਹੀਂ ਲੱਗਦਾ ਸਰ ਤੁਸੀਂ ਡਰਾਈਵਰ ਨੂੰ ਜਲਦੀ ਭੇਜੋ ਧੁੱਪ ਬਹੁਤ ਲੱਗੀ ਹੋਈ ਆ ਬੱਚੇ ਵੀ ਨਾਲ ਸਾਡੇ ਨੇ ਬੱਚਿਆਂ ਤੋਂ ਧੁੱਪ ਨਹੀਂ ਸਹੀ ਜਾਂਦੀ ਸਰ ਤੁਸੀਂ ਡਰਾਈਵਰ ਨੂੰ ਜਲਦੀ ਭੇਜੋ ਸਰ ਅਸੀਂ ਘੁੰਮਣ ਬਹੁਤ ਦੂਰ ਜਾਣਾ ਵੀ ਆ ਹੋਰ ਵੀ ਜਗ੍ਹਾ 'ਤੇ ਘੁੰਮਣ ਜਾਣਾ ਹੋਣਾ ਜਾਣਾ ਵਾ ਅਤੇ ਜੇ ਡਰਾਈਵਰ ਹੀ ਲੇਟ ਹੋ ਗਿਆ ਤਾਂ ਫਿਰ ਸਾਡਾ ਘੁੰਮਣਾ ਅੱਧਾ ਹੀ ਰਹਿ ਜਾਣਾ ਵਾ ਇਸ ਕਰਕੇ ਤੁਸੀਂ ਡਰਾਈਵਰ ਨੂੰ ਜਲਦੀ ਤੋਂ ਜਲਦੀ ਭੇਜੋ ਡਰਾਈਵਰ ਦੀ ਵੇਟ ਅਸੀਂ ਬੜੇ ਟਾਈਮ ਤੋਂ ਕਰ ਰਹੇ ਹਾਂ ਇੱਥੇ ਸੜਕ 'ਤੇ ਖੜੇ ਹੋਣਾ ਵੀ ਬਹੁਤ ਚੰਗਾ ਨਹੀਂ ਲੱਗਦਾ ਅਤੇ ਬੱਚੇ ਵੀ ਬਹੁਤ ਪਰੇਸ਼ਾਨ ਕਰ ਰਹੇ ਨੇ ਤੁਹਾਨੂੰ ਪਤਾ ਟਾਈਮ 'ਤੇ ਥੋ ਇੱਕ ਘੰਟੇ ਦਾ ਹੀ ਫ਼ਰਕ ਪੈ ਜਾਵੇ ਤਾਂ ਕਿੰਨਾ ਹੀ ਟਾਈਮ ਲੱਗ ਜਾਂਦਾ ਵਾ ਤਾਂ ਪਲੀਸ ਸਰ ਤੁਸੀਂ ਨਾ ਡਰਾਈਵਰ ਨੂੰ ਜਲਦੀ ਤੋਂ ਜਲਦੀ ਹੀ ਭੇਜੋ